ਮੈਂ ਕੈਮਰੇ ਦਾ ਬਹੁਤ ਹੀ ਵਧੀਆ ਪਿੱਚਰ ਖਿੱਚ ਕਲਿੱਕ ਕਰਦਾ ਹਾਂ ਮੈਨੂੰ ਕੈਮਰੇ ਦਾ ਸ਼ੌਂ ਬਚਪਨ ਤੋਂ ਹੀ ਸ਼ੌਕ ਹੈ ਕੋਈ ਇਸ ਲਈ ਮੈਂ ਬਚਪਨ ਤੋਂ ਹੀ ਫੋ ਕੈਮਰੇ ਦੀ ਫੋਟੋ ਸ਼ੂਟ ਕਰਦਾ ਆ ਰਿਹਾ ਹਾਂ ਇਸ ਲਈ ਘਰ ਵਿੱਚ ਵੀ ਕੋਈ ਯਾਦਗਾਰੀ ਕੈਮਰੇ ਨਾਲ ਫੋਟਵਾਂ ਪਿੱਚਰਾਂ ਰਹਿ ਜਾਂਦੀਆਂ ਹਨ ਘਰ ਵਿੱਚ ਜਿੱਦਾਂ ਬਰਡੇ ਪਾਰਟੀ ਹੋ ਗਈ ਕਿਤੇ ਮੈਂ ਬਾਹਰ ਘੁੰਮਣ ਫਿਰਨ ਗਿਆ ਧਾਰਮਿਕ ਸਥਾਨ 'ਤੇ ਉੱਥੇ ਫੋਟੋਆਂ ਖਿੱਚ ਲਈਆਂ ਗੁਰੂਆਂ ਦੀਆਂ ਪੀਰਾਂ ਦੀਆਂ ਜਿਹੜੀਆਂ ਵਧੀਆ ਲੱਗੀਆਂ ਕੈਮਰੇ ਵਿੱਚ ਸੇਵ ਕਰਕੇ ਰੱਖ ਲਈਆਂ ਜਦੋਂ ਮੇਰਾ ਮਨ ਹੋਵੇ ਉਦੋਂ ਮੈਂ ਫੋਟੋ ਸ਼ੂਟ ਜ਼ਰੂਰ ਕਰਦਾ ਹਾਂ ਕਿਤੇ ਮੌਸਮ ਵਧੀਆ ਹੋਵੇ ਕਿਤ ਅਤੇ ਉਦੋਂ ਵੀ ਮੈਂ ਕੈਮਰਾ ਆਪਣਾ ਹਰ ਟਾਈਮ ਆਪਣੇ ਨਾਲ ਰੱਖਦਾ ਹਾਂ ਜਦੋਂ ਕਿਤੇ ਮੈਂ ਬਾਹਰ ਜਾਵਾਂ ਹਜੂ ਪਹਾੜਾਂ 'ਤੇ ਵੀ ਜਾ ਘੁੰਮਣ ਫਿਰਨ ਦਾ ਮੈਨੂੰ ਸ਼ੌਕੀਨ ਹਾਂ ਉੱਥੇ ਜਾ ਕੇ ਵੀ ਮੈਂ ਪਹਾੜਾਂ ਦੀ ਫੋਟੋ ਕਲਿੱਕ ਕਰਦਾ ਹਾਂ ਹਰੇਕ ਮੂਵਮੈਂਟ ਆਪਣੇ ਕੈਮਰੇ ਵਿੱਚ ਸੇਵ ਕਰਕੇ ਰੱਖਦਾ ਹਾਂ ਤਾਂ ਕਿ ਜਦੋਂ ਵੀ ਕਿਤੇ ਮਨ ਕਰੇ ਫੋਟੋਆਂ ਦੇਖਣ ਦਾ ਤਾਂ ਉਹਨੂੰ ਦੇਖ ਕੇ ਵਧੀਆ ਲੱਗਦਾ ਫੋਟੋ ਸ਼ੂਟ ਵੀ ਜਿੱਥੇ ਕਰਨਾ ਹੋਵੇ ਉੱਥੇ ਮੈਂ ਕਰਨ ਚਲ ਜਾਂਦਾ ਹਾਂ ਤਾਂ ਕਿ ਮੈਨੂੰ ਕਿਉਂਕਿ ਮੈਨੂੰ ਕੈਮਰੇ ਦਾ ਬਚਪਨ ਤੋਂ ਹੀ ਸ਼ੌਕ ਹੈ ਇਸ ਲਈ ਮੈਂ ਤਸਵੀਰਾਂ ਖਿੱਚਣ ਦਾ ਬਹੁਤ ਹੀ ਸ਼ੌਕੀਨ ਹਾਂ